ਛੇ ਅਪ੍ਰੈਲ ਉੱਨੀ ਸੌ ਬਾਨਵੇਂ ਨੌਂ ਜੂਨ ਉੱਨੀ ਸੌ ਚਾਲੀ ਬਾਰਾਂ ਅਗਸਤ ਉੱਨੀ ਸੌ ਸੱਤਰ ਦਸ ਨਵੰਬਰ ਉੱਨੀ ਸੌ ਪਚਾਨਵੇਂ ਤੇਈ ਅਕਤੂਬਰ ਦੋ ਹਜ਼ਾਰ ਬਾਈ